ਹਾਂਜੀ ਇਹ ਯਕੀਨੀ ਬਣਾਉਣ ਲਈ ਕਿ ਇੱਕ ਨਵੇਂ ਜੰਮੇ ਬੱਚਿਆਂ ਨੂੰ ਇੱਕ ਸਵੱਛ ਵਾਤਾਵਰਨ ਹੋਵੇ ਅਤੇ ਉਹ ਗੈਰ ਸਵੱਛ ਸਥਿਤੀਆਂ ਕਾਰਨ ਬਿਮਾਰ ਨਾ ਹੋਣ ਅਸੀਂ ਬਹੁਤ ਸਾਰੇ ਘਰੇਲੂ ਉਪਾਏ ਕਰਦੇ ਹਾਂ ਜਿਵੇਂ ਕਿ ਬੱਚੇ ਦੀ ਬੈਡ ਸ਼ੀਟ ਸਾਫ ਹੋਣੀ ਚਾਹੀਦੀ ਹੈ ਬੱਚੇ ਦੇ ਕੱਪੜੇ ਸਾਫ ਹੋਣੇ ਚਾਹੀਦੇ ਹਨ ਬੱਚੇ ਨੂੰ ਗੰਦੇ ਹੱਥਾਂ ਦੇ ਨਾਲ ਨਹੀਂ ਚੱਕਣਾ ਚਾਹੀਦਾ ਬੱਚੇ ਨੂੰ ਨਵਜੰਮੇ ਬੱਚੇ ਨੂੰ ਘਰ ਤੋਂ ਬਾਹਰ ਨਹੀਂ ਲੈ ਕੇ ਜਾਣਾ ਚਾਹੀਦਾ ਜਦੋਂ ਵੀ ਅਸੀਂ ਬੱਚੇ ਨੂੰ ਚੁੱਕਣਾ ਹੈ ਜਾਂ ਕਿਸੇ ਹੋਰ ਵਿਅਕਤੀ ਨੇ ਵੀ ਚੁੱਕਣਾ ਹੈ ਤਾਂ ਉਸਨੂੰ ਪਹਿਲਾਂ ਇਹੀ ਕਿਹਾ ਜਾਂਦਾ ਹੈ ਕਿ ਪਹਿਲਾਂ ਆਪਣੇ ਹੱਥ ਧੋਵੋ ਚੰਗੀ ਤਰ੍ਹਾਂ ਫਿਰ ਬੱਚੇ ਨੂੰ ਚੱਕੋ ਬੱਚੇ ਦੇ ਰੋਜ਼ ਕੱਪੜੇ ਬਦਲਣੇ ਚਾਹੀਦੇ ਹਨ ਡੈਟੋਲ ਵਿੱਚ ਬੱਚੇ ਦੇ ਕੱਪੜੇ ਧੋਣੇ ਚਾਹੀਦੇ ਆ ਜਿਸ ਨਾਲ ਬੱਚੇ ਦੇ ਕੱਪੜਿਆਂ ਦੇ ਜੋ ਜਮਸ ਬੈਕਟੀਰੀਆ ਉਹ ਖਤਮ ਹੋਣ ਕਿਉਂਕਿ ਨਵਜੰਮਾ ਬੱਚਾ ਜੋ ਹੈ ਉਹ ਮਾਂ ਦਾ ਦੁੱਧ ਕੱਢ ਦਿੰਦਾ ਹੈ ਜਿਹਦੇ ਕਾਰਨ ਬੱਚੇ ਦੇ ਕੱਪੜੇ ਖਰਾਬ ਹੋ ਜਾਂਦੇ ਆ ਜਿਸ ਕਾਰਨ ਸਾਨੂੰ ਬੱਚੇ ਦੇ ਦਿਨ ਵਿੱਚ ਦੋ ਵਾਰ ਜਾਂ ਘੱਟੋ ਘੱਟ ਇੱਕ ਵਾਰ ਕੱਪੜੇ ਜ਼ਰੂਰ ਬਦਲਣੇ ਚਾਹੀਦੇ ਹਨ ਬੋਤਲਾਂ ਬੱਚੇ ਦੀਆਂ ਬੋਤਲਾਂ ਅਗਰ ਤਾਂ ਬੱਚਾ ਮਾਂ ਦਾ ਦੁੱਧ ਪੀਂਦਾ ਹੈ ਤਾਂ ਠੀਕ ਹੈ ਅਗਰ ਬੱਚਾ ਓਪਰਾ ਦੁੱਧ ਪੀਂਦਾ ਹੈ ਤਾਂ ਉਸ ਦੀਆਂ ਜਿਹੜੀਆਂ ਬੋਤਲਾਂ ਹੁੰਦੀਆਂ ਦੁੱਧ ਵਾਲੀ ਬੋਤਲਾਂ ਉਹਨੂੰ ਗਰਮ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲਣਾ ਚਾਹੀਦਾ ਹੈ ਬੱਚੇ ਨੂੰ ਛੇ ਮਹੀਨੇ ਤੱਕ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ ਓਪਰਾ ਦੁੱਧ ਜਾਂ ਡੱਬੇ ਵਾਲਾ ਦੁੱਧ ਦੀ ਵਰਤੋਂ ਸਾਨੂੰ ਨਹੀਂ ਕਰਨੀ ਚਾਹੀਦੀ ਅਤੇ ਬੱਚੇ ਨੂੰ ਗੈਰ ਸਵੱਛ ਸਥਿਤੀਆਂ ਤੋਂ ਬਿਮਾਰ ਨਾ ਹੋਣ ਉਸ ਦੇ ਲਈ ਸਾਨੂੰ ਬੱਚਿਆਂ ਨੂੰ ਹਮੇਸ਼ਾ ਹੱਥ ਸਾਫ ਕਰਕੇ ਬੱਚੇ ਨੂੰ ਉਠਾਉਣਾ ਚਾਹੀਦਾ ਹੈ ਬੱਚੇ ਦੇ ਆਲੇ ਦੁਆਲੇ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਬੱਚੇ ਦੀ ਬੈਡ ਸ਼ੀਟਸ ਸਾਰਾ ਕੁਝ ਜਿਹੜਾ ਉਹ ਸਾਫ ਹੋਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਬੱਚਿਆਂ ਦੀ ਦੇਖਭਾਲ ਲਈ ਇਹ ਸਭ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ ਜੀ